ਭਾਰਤੀ ਸਮਾਜ ਵਿੱਚ ਧਰਮ ਅਹਿਮ ਭੂਮਿਕਾ ਨਿਭਾਉਂਦਾ ਹੈ ਜਦੋਂ ਕੋਈ ਬੰਦਾ ਧਰਮ ਬਾਰੇ ਗੱਲ ਕਰਦਾ ਹੈ ਤਾਂ ਉਸ ਦਾ ਮਤਲਬ ਹਿੰਦੂ ਮੁਸਲਿਮ ਸਿੱਖ ਇਸਾਈ ਤੋਂ ਹੁੰਦਾ ਹੈ ਹਰ ਕਿਸੇ ਦਾ ਧਰਮ ਨੂੰ ਲੈ ਕੇ ਆਪਣਾ ਇੱਕ ਅਲੱਗ ਨਜ਼ਰੀਆ ਹੈ ਹਰ ਧਰਮ ਦੀ ਆਪਣੀ ਇੱਕ ਮਰਿਆਦਾ ਹੈ ਅਤੇ ਕੁਝ ਬੰਧਨ ਹੁੰਦੇ ਹਨ ਕੁਝ ਲੋਕ ਬੰਧਨ ਹੋਣ ਕਾਰਨ ਵੀ ਧਰਮ ਨੂੰ ਚੰਗਾ ਜਾਂ ਮਾੜਾ ਕਹਿ ਦਿੰਦੇ ਹਨ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਮੈਨੂੰ ਸਾਰੇ ਧਰਮ ਪਸੰਦ ਹਨ ਜਾਂ ਇੱਦਾਂ ਕਹਿ ਲਉ ਕਿ ਸਾਰੇ ਧਰਮਾਂ ਦੇ ਲੋਕ ਮੈਨੂੰ ਪਸੰਦ ਹਨ ਕਿਉਂਕਿ ਸਭ ਕੁ ਸਭ ਵਿੱਚ ਇੱਕ ਨੂਰ ਹੈ ਅਨੇਕਤਾ ਵਿੱਚ ਏਕਤਾ ਬਣਾਈ ਰੱਖਣ ਲਈ ਇੱਕ ਨਾਗਰਿਕ ਵਜੋਂ ਲੋਕਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਧਰਮ ਨੂੰ ਲੈ ਕੇ ਕੋਈ ਹਿੰਸਾ ਪੈਦਾ ਨਾ ਕਰਨ ਇਨਸਾਨ ਦੀ ਸੋਚ ਹੀ ਚੰਗਾ ਜਾਂ ਮਾੜਾ ਕਰਵਾਉਂਦੀ ਹੈ ਜੇਕਰ ਅਸੀਂ ਹਰ ਕਿਸੇ ਲਈ ਚੰਗੀ ਸੋਚ ਰੱਖਦੇ ਹਾਂ ਤਾਂ ਵਾਪਸ ਉਹ ਸਾਡੇ ਕੋਲ ਮੁੜਕੇ ਆਉਂਦੀ ਹੈ ਅਤੇ ਜੇਕਰ ਮਾੜਾ ਵੀ ਸੋਚਦੇ ਹਾਂ ਤਾਂ ਵੀ ਇਸ਼ਵਰ ਦੇਖ ਰਿਹਾ ਹੁੰਦਾ ਹੈ ਸਾਡੀ ਸੋਚ 'ਤੇ ਹੀ ਸਾਡਾ ਆਉਣ ਵਾਲਾ ਸਮਾਂ ਨਿਰਧਾਰਤ ਹੁੰਦਾ ਹੈ